ਯੋਜਨਾਬੱਧ ਹਸਪਤਾਲ ਵਿੱਚ ਭਰਤੀ ਅਜਿਹਾ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਕੋਲ ਹਸਪਤਾਲ ਵਿੱਚ ਦਾਖਲੇ ਦੀ ਯੋਜਨਾ ਬਣਾਉਣ ਲਈ ਕਾਫੀ ਸਮਾਂ ਹੁੰਦਾ ਹੈ ਉਦਾਹਰਣ ਲਈ ਜੇਕਰ ਤੁਹਾਡਾ ਡਾਕਟਰ ਅਗਲੇ ਕੁਝ ਹਫਤਿਆਂ ਵਿੱਚ ਕਿਸੇ ਵੀ ਸਮੇਂ ਹਰਨੀਆਂ ਲਈ ਸਰਜਰੀ ਦੀ ਸਲਾਹ ਦਿੰਦਾ ਹੈ ਤਾਂ ਤੁਹਾਡੇ ਕੋਲ ਆਪਣੇ ਹਸਪਤਾਲ ਵਿੱਚ ਭਰਤੀ ਹੋਣ ਦੀ ਯੋਜਨਾ ਬਣਾਉਣ ਦਾ ਸਮਾਂ ਹੈ ਅਮਰਜੈਂਸੀ ਹਸਪਤਾਲ ਵਿੱਚ ਭਰਤੀ ਇਹ ਆਮ ਤੌਰ 'ਤੇ ਐਮਰਜੈਂਸੀ ਦੇ ਮਾਮਲੇ ਵਿੱਚ ਵਾਪਰਦਾ ਹੈ ਜਿਵੇਂ ਕਿ ਇੱਕ ਸੜਕ ਆਵਾਜਾਈ ਦੁਰਘਟਨਾ